ਸਰਕਾਰ ਦੇ ਵੱਲੋਂ ਜ਼ਿਲ੍ਹੇ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਪ੍ਰਭਾਵ ਪਾਇਆ ਹੈ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਵਿੱਚ ਨਸ਼ਾ ਮੁਕਤ ਦੇਸ਼ ਕਰਨ ਲਈ ਨਸ਼ਾ ਛੁਡਾਉ ਕੇਂਦਰ ਥਾਂ ਥਾਂ 'ਤੇ ਖੋਲ੍ਹੇ ਗਏ ਹਨ ਜਿਨ੍ਹਾਂ ਵਿੱਚ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਨਸ਼ਾ ਮੁਕਤ ਦੇਸ਼ ਬਣਾਈਏ ਹੁਣ ਮਾਈ ਭਾਗੋ ਸਕੀਮ ਵਿੱਚ ਬੱਚੀਆਂ ਨੂੰ ਸਹੂਲਤਾਂ ਦਿੱਤੀਆਂ ਹਨ ਕਿ ਪੜ੍ਹਾਈ ਵਧੀਆ ਕਰਨ ਬੱਚੀਆਂ ਨੂੰ ਬਹੱਤਰ ਪਰਸੈਂਟ ਪੜ੍ਹਾਈ ਵਿੱਚ ਅੰਕ ਆਉਣ ਕਾਰਨ ਸਕੋਲਰਸ਼ਿਪ ਦਿੰਦੇ ਹਨ ਸਕੋਲਰਸ਼ਿਪ ਦਿੰਦੇ ਹਨ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਹਨ ਇਸ ਕਰਕੇ ਬੱਚੇ ਵੱਧ ਤੋਂ ਵੱਧ ਪੜ੍ਹਨ ਇਸ ਕਰਕੇ ਜ਼ਿਲ੍ਹੇ ਵਿੱਚ ਸਰਕਾਰੀ ਦਫਤਰਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਅਤੇ ਸਰਕਾਰੀ ਸਰਕਾਰੀ ਦਫਤਰਾਂ ਨੀਤੀਆਂ ਵਿਕਾਸ ਦੇ ਪ੍ਰਭਾਵ 'ਤੇ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ